ਜੇ ਪਰਿਵਾਰਕ ਪਕਵਾਨਾਂ ਦੀ ਗੱਲ ਕਰੀਏ ਤਾਂ ਕੋਈ ਐਦਾਂ ਦਾ ਤਾਂ ਨਹੀਂ ਹੈਗਾ ਵੀ ਜਿਹੜਾ ਸਾਨੂੰ ਕਿਹਾ ਜਾਵੇ ਪੀੜੀ ਦਰ ਪੀੜੀ ਮਿਲਿਆ ਪਰ ਅਸੀਂ ਸਾਗ ਦੀ ਗੱਲ ਕਰੀਏ ਤਾਂ ਸਾਗ ਜਿਹੜਾ ਇੱਕ ਪੰਜਾਬੀ ਪਕਵਾਨ ਹੈਗਾ ਜਿਹੜਾ ਮਤਲਬ ਬਣਾਉਣ ਦਾ ਆਪਣਾ ਵੱਖਰਾ ਤਰੀਕਾ ਹਰੇਕ ਦਾ ਵੱਖਰਾ ਤਾਂ ਮਤਲਬ ਵੀ ਸਵਾਦ ਹਰੇਕ ਦਾ ਵੱਖਰਾ ਪਰ ਹੈ ਵੀ ਮੇਨ ਪੰਜਾਬੀ ਭੋਜਨ ਇਸ ਕਰਕੇ ਮੇਰੀ ਮਾਤਾ ਜੀ ਬੜਾ ਸਵਾਦ ਬਣਾਉਂਦੇ ਨੇ ਉਹ ਅਤੇ ਉਹਨਾਂ ਨੇ ਮੈਨੂੰ ਇਹ ਜਿਹੜਾ ਇਹਨੂੰ ਸਾਗ ਬਣਾਉਣ ਦਾ ਤਰੀਕਾ ਦੱਸਿਆ ਵੀ ਇਸ ਤਰ੍ਹਾਂ ਨਾਲ ਉਹਨੂੰ ਜ਼ਿਆਦਾ ਅੱਗ ਦੇ ਉੱਤੇ ਲੰਬੇ ਸਮੇਂ ਤੱਕ ਜੇ ਪਕਾਵਾਂਗੇ ਤਾਂ ਉਹਦਾ ਸਵਾਦ ਜਿਹੜਾ ਵੱਧ ਕੇ ਆਉਂਦਾ ਅਤੇ ਇਹਦੇ 'ਚ ਵੀ ਜਿਹੜੀ ਹੈਗੀ ਬਣਾ ਤਾਂ ਹਰੇਕ ਏ ਲੈਂਦਾ ਪਰ ਜਿਹੜਾ ਸਾਗ ਆਪਾਂ ਕਹੀਏ ਵੀ ਹਰੇਕ ਉਹਦੇ 'ਚ ਕੀ ਕੀ ਕੁਝ ਪੈਣਾ ਕਿੰਨੇ ਸਮੇਂ ਲਈ ਪਕਾਉਣਾ ਉਹ ਹਰੇਕ ਦੇ ਵੱਸ ਦੀ ਗੱਲ ਨਹੀਂ ਹੈਗੀ ਅਤੇ ਮੇਰੇ ਮਾਤਾ ਜੀ ਨੇ ਮੈਨੂੰ ਇਹ ਦੱਸਿਆ ਵੀ ਬੇਟਾ ਪਹਿਲਾਂ ਤਾਂ ਸਾਗ ਜਿਹੜਾ ਉਹ ਜਦੋਂ ਆਪਾਂ ਘਰ ਦਾ ਤੋੜਦੇ ਹਾਂ ਉਹਦੇ 'ਚ ਜਿੰਨੀਆਂ ਚੀਜ਼ਾਂ ਤੁਸੀਂ ਵੱਧ ਪਾਓਗੇ ਮੇਥੀ ਮ ਲਸਣ ਅਦਰਕ ਹਰੀਆਂ ਮਿਰਚਾਂ ਹਾਲਿਓ ਜਿੰਨੀਆਂ ਆਪਾਂ ਵੱਧ ਚੀਜ਼ਾਂ ਪਾਵਾਂਗੇ ਓਨਾ ਹੀ ਇਹ ਵੱਧ ਸਵਾਦ ਬਣਦਾ ਅਤੇ ਦੂਜਾ ਇਹ ਹੈ ਵੀ ਇਹਦੇ 'ਚ ਮੱਠੀ ਅੱਗ ਦੇ ਉੱਤੇ ਰੱਖ ਕੇ ਆਪਾਂ ਨੇ ਜਿੰਨਾ ਵੱਧ ਸਮਾਂ ਪਕਾਵਾਂਗੇ ਓਨਾ ਇਹ ਵੱਧ ਸਵਾਦ ਬਣਨਾ ਇਹ ਜਿਹੜਾ ਹੈਗਾ ਸਾਨੂੰ ਮਤਲਬ ਗਾਹਾਂ ਜਿਵੇਂ ਪਹਿਲਾਂ ਮੇਰੀ ਨਾ ਮਾਤਾ ਨੂੰ ਮੇਰੀ ਨਾਨੀ ਨੇ ਦੱਸਿਆ ਨਾਨੀ ਨੇ ਗਾਹਾਂ ਮਾਤਾ ਨੇ ਮੇਰੀਆਂ ਨੇ ਮੈਨੂੰ ਦੱਸਿਆ ਅਤੇ ਮੈਂ ਹੁਣ ਕਹਾਂ ਵੀ ਉਹਦੇ ਨਾਲ ਜਿਹੜਾ ਵੀ ਮੇਰਾ ਸਾਗ ਖਾਂਦਾ ਉਹ ਹਰੇਕ ਮੈਨੂੰ ਜ਼ਰੂਰ ਕਹਿੰਦਾ ਵੀ ਤੁਸੀਂ ਕਿਵੇਂ ਬਣਾਉਂਦੇ ਹੋ ਸਾਨੂੰ ਜ਼ਰੂਰ ਦੱਸੋ ਇਹ ਬੜਾ ਸੁਆਦ ਤੁਹਾਡਾ ਸਾਗ ਹੁੰਦਾ ਪਰ ਇਹਦੇ 'ਚ ਕਹਾਂ ਵੀ ਕੋਈ ਐਂ ਨਹੀਂ ਹੈਗਾ ਵੀ ਇਹਦੇ 'ਚ ਆਪਾਂ ਚੀਜ਼ਾਂ ਹੋਰ ਕੋਈ ਪਾਉਂਦੇ ਹਾਂ ਮੈਂ ਅੱਡ ਤੋਂ ਪਾਉਂਦੀ ਹਾਂ ਪਰ ਸਿਰਫ਼ ਜਿਹੜੇ ਪਕਾਉਣ ਦੀ ਵਿਧੀ ਆ ਨਾ ਤਾਂ ਇਹਨੂੰ ਜ਼ਿਆਦੇ ਅੱਗ 'ਤੇ ਰੱਖਣਾ ਨਾ ਇਹਨੂੰ ਬਹੁਤੀ ਮੱਠੀ ਅੱਗ 'ਤੇ ਰੱਖਣਾ ਵਿੱਚ ਵਿਚਾਲੇ ਜਿਹੜੀ ਅੱਗ ਹੈ ਉਹਦੇ 'ਤੇ ਵੀ ਹਾਂ ਓਨਾ ਟਾਇਮ ਜਿਹੜੀ ਕੂਕਿੰਗ ਦਾ ਤਰੀਕਾ ਹੈ ਉਹਦੇ ਨਾਲ ਜ਼ਰੂਰ ਫਰਕ ਪੈਂਦਾ ਜਿਹੜਾ ਸਵਾਦ ਨੂੰ ਅੱਡ ਕਰਦਾ ਦੂਜਿਆਂ ਨਾਲੋਂ ਇਹੀ ਮਤਲਬ ਮੈਂ ਕਹਿ ਸਕਦੀ ਹਾਂ ਵੀ ਇਹਦਾ ਹੋਰ ਤਾਂ ਕੋਈ ਖਾਸ ਗੁਰ ਨਹੀਂ ਹੈਗਾ